ਤਿੰਨ ਅਪ੍ਰੈਲ ਉੱਨੀ ਸੌ ਛਿਆਨਵੇਂ ਨੌ ਅਪ੍ਰੈਲ ਦੋ ਹਜ਼ਾਰ ਇੱਕ ਤੀਹ ਅਗਸਤ ਉੱਨੀ ਸੌ ਅਠਾਸੀ ਇੱਕ ਨਵੰਬਰ ਉੱਨੀ ਸੌ ਪਚਾਨਵੇਂ ਸੱਤ ਅਪ੍ਰੈਲ ਉੱਨੀ ਸੌ ਸਤਾਨਵੇਂ